ਹੈਲੋ ਹਾਂਜੀ ਹਾਂਜੀ ਬਰਨਾਲਾ ਕ ਬਰਨਾਲਾ ਹਾਂਜੀ ਠੀਕ ਹੈ

ਬਿਲਕੁਲ ਦੇਖੋ ਜੀ ਸਾਡੇ ਕਲੱਬ 'ਚ ਦੇਖੋ ਪਹਿਲਾਂ ਤਾਂ ਬੱਚਿਆਂ ਦਾ ਇੰਟਰਸਟ ਦੇਖੋ ਤੁਸੀਂ ਕਿਹੜੀ ਗੇਮ ਦੇ ਵਿੱਚ ਹੈ ਸਾਡੇ ਕੋਲ ਬਾਸਕਿਟਬਾਲ ਹੈ ਜੀ ਬੈਡਮਿੰਟਨ ਹੈ ਸਵਿਮਿੰਗ ਆ ਅਤੇ ਜੇ ਹੋਰ ਅਥ ਆਪਣੀ ਜਿਹੜੀ ਐਥਲੈਟਿਕ ਗੇਮਸ ਨੇ ਉਹ ਨੇ ਜੀ ਵੇਟ ਲਿਫਟਿੰਗ ਉਹ ਵੀ ਹੈ ਜੇ ਜਿੰਮ ਵਗੈਰਾ ਬੱਚਿਆਂ ਦਾ ਇੰਟਰਸਟ ਆ ਇਹ ਸਾਰੀਆਂ ਗੇਮਾਂ ਸਾਡੇ ਕੋਲ ਹੈਗੀਆਂ ਨੇ ਅਤੇ ਸਾਡੇ ਕੋਲ ਇਹਦੇ ਨਾਲ ਵੀ ਜਿਹੜੇ ਵੀ ਸਾਡੇ ਕੋਲ ਜਿਹੜੇ ਕੋਚ ਵੀ ਨੇ ਇਹਨਾਂ ਗੇਮਾਂ ਲਈ ਸਪੈਸ਼ਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਮੇਲ ਔਰ ਫੀਮੇਲ ਲਈ ਦੋਨੋ ਦੋਨੋਂ ਸੇਮ ਹੀ ਹੈ ਬਸ ਤੁਸੀਂ ਬੱਚੇ ਦਾ ਇੰਟਰਸਟ ਦੇਖੋ ਕਿਹੜੀ ਗੇਮ ਦੇ ਵਿੱਚ ਆ ਬੱਚੇ ਦਾ ਇੰਟਰਸਟ ਜੇਕਰ ਬਾਸਕਿਟਬਾਲ 'ਚ ਆ ਤਾਂ ਇਹ ਕੋਈ ਮੈਟਰ ਨਹੀਂ ਕਰਦਾ ਵੀ ਕੁੜੀ ਆ ਜਾਂ ਮੁੰਡਾ ਦੋਵਾਂ ਲਈ ਆ ਦੋਵਾਂ ਲਈ ਕੋਚ ਵੀ ਹੈਗੇ ਨੇ ਮੇਲ ਮੇਲ ਕੋਚ ਵੀ ਹੈਗੇ ਨੇ ਅਤੇ ਫੀ ਫੀਮੇਲ ਕੋਚ ਵੀ ਹੈਗੇ ਨੇ ਕਿਹੜੀਆਂ ਗੇਮਸ ਨਹੀਂ ਨਹੀਂ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਸਾਡੇ ਕੋਲ ਸਿਰਫ਼ ਬਿਲਕੁਲ ਬਿਲਕੁਲ ਸਾਡੇ ਕੋਲ ਸਾਰੀਆਂ ਜਿਹੜੀਆਂ ਮੋਸਟਲੀ ਗੇਮ ਨੇ ਉਹ ਉਹ ਇੰਨਡੋਰ ਹੀ ਨੇ ਹਾਂਜੀ ਹਾਂਜੀ ਅਤੇ ਇਹਦੇ ਲਈ ਸਾਡੇ ਕੋਲ ਸਪੈਸ਼ਲ ਕੋਚ ਪ੍ਰਾਈਜ ਇਹਦਾ ਇਹ ਆ ਵੀ ਦਸ ਹਜ਼ਾਰ ਰੁਪਏ ਪਰ ਮੰਥ ਨੇ ਇਹਦਾ ਪ੍ਰਾਈਜ਼ ਪਰ ਨਹੀਂ ਨਹੀਂ ਇੱਕ ਬੱਚੇ ਦਾ ਅਤੇ ਜੇ ਮਤਲਬ ਵੀ ਬ੍ਰਦਰ ਸਿਸਟਰ ਆ ਉਹਦੇ ਵਿੱਚ ਇੱਕ ਦੂਸਰੇ ਬੱਚੇ ਦੀ ਜਿਹੜੀ ਫੀਸ ਆ ਉਹ ਵੀ ਉਹ ਹਾਫ ਹਾਫ ਹੋ ਜਾਏਗੀ ਤਾਂ ਜਿਹੜਾ ਦੂਸਰਾ ਬੱਚਾ ਗਾ ਉਹਨੂੰ ਦਸ ਹਜ਼ਾਰ ਦੇਣ ਦੀ ਲੋੜ ਨਹੀਂ ਉਹਦੀ ਸਿਰਫ਼ ਜਿਹੜੀ ਫੀਸ ਆ ਉਹ ਪੰਜ ਹਜ਼ਾਰ ਹੋਜੂਗੀ ਟਾਈਮਿੰਗ ਸੁਬਹਾ ਅੱਠ ਤੋਂ ਸ਼ਾਮ ਨੂੰ ਅੱਠ ਵਜੇ ਤੱਕ ਬਿਲਕੁਲ ਬਿਲਕੁਲ ਹਾਂਜੀ ਅਸੀਂ ਸਾਡਾ ਜਿਹੜਾ ਕਲੱਬ ਉਹ ਬਾਰ੍ਹਾਂ ਘੰਟੇ ਓਪਨ ਹੁੰਦਾ ਗਾ ਬੱਚਿਆਂ ਨੂੰ ਦੇਖੋ ਪੰਜਤਾਲੀ ਮਿੰਟ ਦਾ ਜਿਹੜਾ ਸਲੋਟ ਹੁੰਦਾ ਗਾ ਉਹ ਦਿੰਦੇ ਅਸੀਂ ਉਹ ਕਰਦੇ ਹਾਂ ਬੱਚੇ ਦਾ ਵੀ ਕਿੰਨੇ ਤੋਂ ਕਿੰਨੇ ਓਹਣੇ ਕਰਨੀ ਆ ਉਸ ਤੋਂ ਬਸ ਉਹ ਪੰਜਤਾਲੀ ਮਿੰਟ ਬੱਚੇ ਨੂੰ ਅਸੀਂ ਪਰਸਨਲ ਟ੍ਰੇਨਿੰਗ ਦਵਾਂਗੇ ਕਿਸੇ ਵੀ ਗੇਮ ਦੀ ਉਸ ਤੋਂ ਬਾਅਦ ਜੇ ਬੱਚਾ ਆਪ ਖੁਦ ਕੋਈ ਗੇਮ ਖੇਡਣਾ ਚਾਹੁੰਦਾ ਗਾ ਜਾਂ ਜਿੰਮ ਕਰਨਾ ਚਾਹੁੰਦਾ ਗਾ ਤਾਂ ਉਹ ਬੱਚਾ ਸ਼ੌਕ ਨਾਲ ਕਰ ਸਕਦਾ ਹੈਗਾ ਉਹਦੀ ਕੋਈ ਟਾਈਮ ਲਿਮਿਟ ਨਹੀਂ ਹੈਗੀ ਹਾਂਜੀ ਠੀਕ ਹੈ ਜੀ ਓਕੇ ਥੈਂਕ ਯੂ